ਮੇਰੀ ਮਨਪਸੰਦ ਕਵਿਤਾ ਹੈ ਆਖਦੇ ਹਾਂ ਅਸੀਂ ਮੈਨੂੰ ਇਹ ਲਿਖਣ ਵਿੱਚ ਇਸ ਚੀਜ਼ ਨੇ ਪ੍ਰੇਰਿਤ ਕੀਤਾ ਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੇ ਬੱਚੇ ਸਿੱਖੀ ਧਰਮ ਨਾਲ ਟੁੱਟ ਕੇ ਮੋਬਾਈਲਾਂ ਵਿੱਚ ਪਏ ਹੋਏ ਹਨ ਮੋਬਾਈਲਾਂ ਦੇ ਕਾਰਨ ਬਹੁਤ ਜ਼ਿਆਦਾ ਸਾਡੇ ਬੱਚੇ ਵਿਗੜ ਰਹੇ ਹਨ ਮੈਂ ਆਮ ਤੌਰ 'ਤੇ ਪੰਜਾਬੀ ਭਾਸ਼ਾ ਵਿੱਚ ਲਿਖਣਾ ਪਸੰਦ ਕਰਦੀ ਹਾਂ ਇਹ ਕਵਿਤਾ ਹੈ ਬੱਚੇ ਸਿੱਖੀ ਨਾਲ ਟੁੱਟੇ ਨੇ ਪਹਿਲੇ ਆਪਣੇ ਬੱਚਿਆਂ ਦਾ ਪੱਖ ਰਹਿੰਦੇ ਬੋਲਦੇ ਨੱਚਣ ਪੋਰਾਂ 'ਚ ਅਤੇ ਟੀਵੀਆਂ 'ਚ ਦੇਖਦੇ ਨੇ ਉਸ ਸਮੇਂ ਕਿਉਂ ਨਹੀਂ ਮਾਪੇ ਬੱਚਿਆਂ ਨੂੰ ਗੌਲਦੇ ਪਹਿਲਾ ਮਾਵਾਂ ਸਾਖੀਆਂ ਸੁਣਾਉਂਦੀਆਂ ਸੀ ਬੱਚਿਆਂ ਨੂੰ ਭਰਦੀਆਂ ਸੀ ਜਜ਼ਬੇ ਸਿੱਖੀ ਦਸਤੂਰ ਦੇ ਅੱਜ ਦੀਆਂ ਮਾਵਾਂ ਗੋਦੀ ਵਿੱਚ ਲੈ ਕੇ ਬੱਚਿਆਂ ਨੂੰ ਸੀਰੀਅਲ ਦੇਖਦੀਆਂ ਨੇ ਏਕਤਾ ਕਪੂਰ ਦੇ ਉਏ ਬੀਜਦੇ ਹੋ ਕਿੱਕਰਾਂ ਭਾਲਦੇ ਹੋ ਅੰਗੂਰ ਤੁਸੀਂ ਉਏ ਬੀਜਦੇ ਹੋ ਕਿੱਕਰਾਂ ਅਤੇ ਭਾਲਦੇ ਹੋ ਅੰਗੂਰ ਤੁਸੀਂ ਰੋੜਾ ਵੱਟੇ ਲੱਭਦੇ ਹੋ ਲੱਡੂ ਮੋਤੀਚੂਰ ਦੇ ਅੱਜ ਕੱਲ੍ਹ ਬੰਦਾ ਉਹ ਕੰਮ ਕਰਦਾ ਜਿਹੜਾ ਉਹਦੇ ਮਨ ਨੂੰ ਚੰਗਾ ਲੱਗਦਾ ਸਿੱਖ ਮੁੰਡੇ ਵੀ ਟੋਪੀਆਂ ਪਾਈ ਫਿਰਦੇ ਇੰਨਾ ਜ਼ੋਰ ਅੱਜ ਫੈਸ਼ਨ ਦੀ ਅੱਗ ਦਾ ਨਹੀਂ ਕਿਸੇ ਪੈਰ ਬਿਨਾ ਟੌਹਰ ਇੰਨਾ ਜਿੰਨਾ ਟੌਹਰ ਸਰਦਾਰ ਦੀ ਪੱਗ ਦਾ ਪੱਗ ਨਹੀਂ ਸਰਦਾਰੀ ਦਾ ਤਾਜ ਹੈ ਇਸ ਨੂੰ ਸਿਰ ਤੋਂ ਕਦੀ ਨਾ ਲਾਹੀ ਵਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਆਪਣੀ ਗੋਦੀ ਵਿੱਚ ਬਹਿਣ ਦੇਣਾ ਤਜਬੇ ਜ਼ਿੰਦਗੀ ਬਦਲ ਗਈ ਬੱਚਿਆਂ ਦੀ ਕਦਰਾਂ ਕੀਮਤਾਂ ਗਈਆਂ ਨੇ ਖੋਹ ਅੱਜ ਕੱਲ੍ਹ ਬਰਗਰ ਖਾ ਖਾ ਕੇ ਬਰਗਰ ਖਾ ਖਾ ਕੇ ਬਰਗਰ ਹੋਈ ਜਾਂਦੇ ਨੇ ਭੁੱਲ ਗਏ ਨੇ ਕੇਲੇ ਅਤੇ ਸਿਉ ਅੱਜ ਕੱਲ੍ਹ ਦੁੱਧ ਇਹਨਾਂ ਦੀਆਂ ਦੰਦੀਆਂ ਵੱਢਦਾ ਹੈ ਵੱਢਦਾ ਹੈ ਦੇਸੀ ਘਿਓ ਅੱਜ ਕੱਲ੍ਹ ਮਾਈਨੇ ਬਦਲ ਗਏ ਪਿਆਰ ਔਰ ਦੋਸਤੀ ਦੇ ਉੱਡਣ ਅਰਸਾਂ ਤੋਂ ਖੁਸ਼ਬੂ ਅੱਜ ਕੱਲ੍ਹ ਵੱਖੋ ਵੱਖਰੇ ਕਮਰੇ ਨੇ ਬੱਚਿਆਂ ਦੇ ਅੰਦਰ ਹੀ ਬੂਹੇ ਰਹਿੰਦੇ ਢੋਹ ਅੱਜ ਕੱਲ੍ਹ ਮੋਬਾਈਲ ਇਹਨਾਂ ਦੀ ਮਾਂ ਬਣਿਆ ਕੰਪਿਊਟਰ ਇਹਨਾਂ ਦਾ ਪਿਓ ਅੱਜ ਕੱਲ੍ਹ ਇਸ ਲਈ ਬੱਚਿਆਂ ਦਾ ਅੱਜ ਕੱਲ੍ਹ ਸਭ ਰਹਿਣ ਸਹਿਣ ਤਰੀਕਾ ਬੋਲਣ ਚੱਲਣ ਆਦਰ ਸਤਿਕਾਰ ਸਭ ਬਦਲ ਚੁੱਕਿਆ ਹੈ